ਜੇਕਰ ਮੈਂ ਪਿਛਲੇ ਯੁੱਗ ਵਿੱਚ ਜਾਣਾ ਚਾਹਵਾਂ ਤਾਂ ਮੈਂ ਸੌ ਸਾਲ ਪਿੱਛੇ ਜਾਣਾ ਚਾਹਾਂਗਾ ਜਿਸ ਵਿੱਚ ਮੈਂ ਦੇਖਣਾ ਚਾਹਾਂਗਾ ਕਿ ਸਾਡਾ ਹੁਣ ਦੀ ਧਰਤੀ ਅਤੇ ਪਿਛਲੀ ਜੋ ਸੌ ਸਾਲ ਪਹਿਲੇ ਧਰਤੀ ਸੀ ਉਸ ਵਿੱਚ ਕੀ ਫਰਕ ਸੀ ਜ਼ਮੀਨ ਅਸਮਾਨ ਦਾ ਫਰਕ ਦਿਖੇਗਾ ਇਸ ਦਾ ਕਾਰਨ ਜੋ ਅਸੀਂ ਹੁਣ ਦੇਖ ਰਹੇ ਹਾਂ ਪੇੜ ਪੌਦੇ ਕੱਟ ਦਿੱਤੇ ਗਏ ਨੇ ਜੋ ਸਾਡੇ ਮੇਨ ਪੰਜਾਬ ਦੇ ਬੋਹੜ ਦਰੱਖਤ ਸੀ ਪਿੱਪਲ ਸੀ ਮੇਨ ਜਿਨ੍ਹਾਂ ਦੀ ਉਮਰ ਸੌ ਸੌ ਸਾਲ ਹੁੰਦੀ ਸੀ ਹਜ਼ਾਰਾਂ ਸਾਲ ਵੀ ਬੋਹੜ ਦੀ ਦਰੱਖਤ ਦੀ ਹੁੰਦੀ ਸੀ ਉਮਰ ਉਸ ਨੂੰ ਮੈਂ ਦੇਖਣਾ ਚਾਹਾਂਗਾ ਆਪਣੀ ਕਿਸ ਤਰ੍ਹਾਂ ਦੇ ਘਰ ਸੀ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ ਜੋ ਪਿੱਛੇ ਬੀਤ ਗਿਆ ਉਸ ਨੂੰ ਮੈਂ ਦੇਖਣ ਦਾ ਚਾਹਵਾਨ ਹੋਵਾਂਗਾ ਇਸ ਯੁੱਗ ਵਿੱਚ ਜੋ ਸਾਡੇ ਨਾਲ ਵਾਪਰ ਰਿਹਾ ਇਹ ਅੱਜ ਕੱਲ੍ਹ ਤੇਜ਼ ਤਕਨੀਕ ਹੋਣ ਕਾਰਨ ਟੈਕਨੋਲਜੀ ਦਾ ਬੈਨੀਫਿਟ ਵੀ ਹੈ ਅਤੇ ਨੁਕਸਾਨ ਵੀ ਹੋਇਆ ਜੋ ਬੈਕ ਸਾਈਡ ਸੀ ਸਾਡਾ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਸੀ ਹੁਣ ਦਾ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਹੈ ਇਨਵਾਇਰਮੈਂਟ ਦੇ ਕਾਰਨ ਜੋ ਪ੍ਰਦੂਸ਼ਣ ਹੋਇਆ ਜੋ ਪਿੱਛੇ ਹੈ ਉਸ ਵਿੱਚ ਕੋਈ ਬਾਈਕ ਜਾਂ ਪੈਟਰੋਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਉਸ ਨੂੰ ਮੈਂ ਦੇਖਣਾ ਚਾਹਾਂਗਾ ਅਤੇ ਮੈਂ ਚਾਹਾਂਗਾ ਕਿ ਉਸ ਤੋਂ ਉਹ ਚੀਜ਼ਾਂ ਜੋ ਸਾਨੂੰ ਬੈਨੀਫਿਟ ਸੀ ਉਹ ਸਾਨੂੰ ਦੇਖਣ ਨੂੰ ਮਿਲਣ ਮੈਂ ਉਹ ਚੀਜ਼ਾਂ ਲੈ ਕੇ ਆਵਾਂ ਜੋ ਸਾਡੇ ਬਜ਼ੁਰਗ ਜੋ ਸਾਡੇ ਏਜ਼ਡ ਪਰਸਨ ਯੂਜ ਕਰਦੇ ਸੀ ਉਹ ਦੇਖਣ ਦਾ ਨਜ਼ਾਰਾ ਹੀ ਵੱਖਰਾ ਹੋਵੇਗਾ ਜਿਸ ਤਰ੍ਹਾਂ ਅੱਜ ਕੱਲ੍ਹ ਚੱਲ ਰਿਹਾ ਕਿਸੇ ਕੋਲ ਕਿਸੇ ਕੋਲ ਇੱਕ ਦੂਜੇ ਲਈ ਟਾਈਮ ਨਹੀਂ ਹੈ ਜੋ ਪਿੱਛੇ ਲੋਕ ਇੱਕ ਦੂਜੇ ਦੀ ਹੈਲਪ ਜਾਂ ਬੈਠ ਕੇ ਗੱਲਾਂ ਬਾਤਾਂ ਕਰਦੇ ਸੀ ਮੈਂ ਉਹ ਦੇਖਣ ਦਾ ਚਾਹਵਾਨ ਹੋਵਾਂਗਾ ਮੈਂ ਸੌ ਸਾਲ ਪਿੱਛੇ ਜਾਣਾ ਚਾਹਾਂਗਾ ਇਸ ਨਾਲ ਅਸੀਂ ਬਹੁਤ ਸਾਰੀਆਂ ਆਪਣੀਆਂ ਯਾਦਾਂ ਹੀ ਇਕੱਠੀਆਂ ਕਰਾਂਗਾ ਆਪਣੀਆਂ ਅਤੇ ਉਹਨਾਂ ਨੂੰ ਯਾਦਾਂ ਨੂੰ ਲੈ ਕੇ ਵਾਪਸ ਫਿਊਚਰ ਵਿੱਚ ਫਿਰ ਆਵਾਂਗਾ ਪ੍ਰੈਜੈਂਟ ਵਿੱਚ ਫਿਰ ਵਾਪਸ ਆਵਾਂਗਾ ਜੋ ਕਿ ਸਾਨੂੰ